ਕੁਝ ਆਨਲਾਈਨ ਸਾਈਟਾਂ ਇਹੋ ਜਿਹੀਆਂ ਹੁੰਦੀਆਂ ਜਿੱਦਾਂ ਇੰਸਟਾਗਰਾਮ ਹੋ ਗਿਆ ਇੰਸਟਾਗਰਾਮ 'ਤੇ ਅਸੀਂ ਕਿਸੇ ਦੀ ਪ੍ਰੋਫਾਈਲ ਬਣਾ ਸਕਦੇ ਹਾਂ ਅਤੇ ਜਿੱਦਾਂ ਫੇਸਬੁੱਕ ਹੋ ਗਿਆ ਫੇਸਬੁੱਕ ਦੇ ਉੱਤੇ ਅਸੀਂ ਕਿਸੇ ਦਾ ਕਿਸੇ ਦਾ ਕੋਂਟੈਕਟ ਨੰਬਰ ਕਿਸੇ ਦੀ ਇਨਫੋਰਮੇਸ਼ਨ ਕੱਢ ਸਕਦੇ ਹਾਂ ਠੀਕ ਹੈ ਅਤੇ ਫੇਸਬੁਕ 'ਤੇ ਅਸੀਂ ਨਿਊਜ਼ ਵਗੈਰਾ ਸੁਣ ਸਕਦੇ ਹਾਂ ਅਸੀਂ ਸੀਰੀਅਲ ਵਗੈਰਾ ਦੇਖ ਸਕਦੇ ਹਾਂ ਫੇਸਬੁੱਕ 'ਤੇ ਅਸੀਂ ਕਿਚਨ ਜੋ ਕੋਰਸਿਜ਼ ਹੁੰਦੇ ਆ ਰਸੋਈ ਦੇ ਕੋਰਸ ਰਸੋਈ ਦੇ ਵਿੱਚ ਕੁਝ ਖਾਣਾ ਬਣਾਉਣਾ ਉਹ ਸਿੱਖ ਸਕਦੇ ਹਾਂ ਅਤੇ ਇੰਸਟਾਗਰਾਮ ਦੇ ਉੱਤੇ ਸਨ ਅਸੀਂ ਕਿਸੇ ਦੀ ਨਵੀਂ ਪ੍ਰੋਫਾਈਲ ਬਣਾ ਸਕਦੇ ਹਾਂ ਅਤੇ ਫੇਸਬੁੱਕ ਦੇ ਉੱਤੇ ਕੋਈ ਵਧੀਆ ਪ੍ਰੋਫਾ ਆਪਣੀ ਫੇਸਬੁੱਕ ਦੇ ਉੱਤੇ ਪ੍ਰੋਫਾਈਲ ਬਣਾ ਸਕਦੇ ਹਾਂ ਅਤੇ ਇੱਦਾਂ ਹੀ ਹੋਰ ਆਨਲਾਈਨ ਸਾਈਟਾਂ ਹੈਗੀਆਂ ਨੇ ਜਿੱਦਾਂ ਐਮਾਜ਼ੋਨ ਹੋ ਗਿਆ ਐਮਾਜ਼ੋਨ ਦੇ ਉੱਤੇ ਵਧੀਆ ਖਰੀਦਦਾਰੀ ਹੋ ਸਕਦੀ ਆ ਵਧੀਆ ਖਰੀਦਦਾਰੀ ਕਰਦੇ ਹਾਂ ਅਸੀਂ ਅਤੇ